ਹੈਲੋ ਆਪਣੇ ਭਾਈ ਜੀ ਤੁਸੀਂ ਪਲੰਬਰ ਬੋਲਦੇ ਹੋ ਗੁਪਤਾ ਸ਼ੋਪ ਜੀ ਤੋਂ ਭਾਅ ਜੀ ਆਪਣੇ ਘਰ ਥੋੜ੍ਹੀ ਟੂਟੀਆਂ ਦੀ ਲੀਕੇਜ ਹੋ ਗਈ ਸੀ ਆਪਣੇ ਉੱਪਰ ਜਿਹੜੇ ਛੱਤ 'ਤੇ ਬਾਥਰੂਮ ਸੀ ਉਹ ਵੀ ਸਾਰੇ ਲੀਕ ਕਰਦੇ ਹੈ ਜੀ ਅਤੇ ਅਤੇ ਆਪਣੇ ਇੱਕ ਅੰਦਰ ਇੱਕ ਪਾਈਪ ਵੀ ਲੀਕ ਕਰਦੀ ਹੈ ਜੀ ਨਹੀਂ ਜੀ ਪਹਿਲਾਂ ਮੈਂ ਕਿਸੇ ਹੋਰ ਤੋਂ ਕਰਵਾਈ ਸੀ ਰਾਮਾ ਵਾਲਿਆਂ ਤੋਂ ਕਰਵਾਈ ਸੀ ਹਾਂਜੀ ਮੈਨੂੰ ਕਿਸੇ ਨੇ ਤੁਹਾਡਾ ਨੰਬਰ ਦਿੱਤਾ ਕਿ ਉਹਨਾਂ ਦੇ ਵਧੀਆ ਕੰਮ ਕਰਦੇ ਹੈ ਤੁਸੀਂ ਗੁਪਤਾ ਹਾਂਜੀ ਮੈਨੂੰ ਨੰਬਰ ਲੈ ਕੇ ਤੁਹਾਡਾ ਹਾਂਜੀ ਹਾਂਜੀ ਸ਼ਾਮ ਤੱਕ ਛੇ ਵਜੇ ਤੱਕ ਕਰ ਦੋਗੇ ਜੀ ਅੱਜ ਤੁਸੀਂ ਥੋੜ੍ਹਾ ਕਰ ਦਿੰਦੇ

ਅੱਛਾ ਜੀ ਅਤੇ ਆਪਣੇ ਘਰ ਨਾ ਪਾਣੀ ਪਾਣੀ ਬਹੁਤ ਜ਼ਰੂਰੀ ਸੀ ਸਾਰਾ ਵਿਹੜੇ 'ਚ ਪਾਣੀ ਪਾਣੀ ਹੋ ਰੱਖਿਆ ਛੱਤ 'ਤੇ ਵੀ ਪਾਣੀ ਪਾਣੀ ਹੋ ਰੱਖਿਆ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਹਾਂਜੀ

ਹਾਂਜੀ ਅਤੇ ਹਾਂਜੀ ਹਾਂਜੀ ਅਤੇ ਤੁਹਾਡੇ ਕੋਲ ਕੋਈ ਹੋਰ ਬੰਦਾ ਹੈ ਨਹੀਂ ਜੀ ਅੱਛਾ ਜੀ ਅਤੇ ਤੁਹਾਡੇ ਕੋਈ ਹੋਰ ਜਾਣਕਾਰੀ ਦੇ ਵਿੱਚ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਆਪਣੇ ਕੋਲ ਇਹ ਸਮਾਨ ਫਿਰ ਕਿੱਥੋਂ ਮਿਲੂਗਾ ਜੀ ਇਹ ਵਾਲਾ ਆਪਣੀ ਇੱਧਰ ਸ਼ੋਪ 'ਤੇ ਵੀ ਮਿਲ ਜੂਗਾ ਜੀ ਇਹ ਸਾਰਾ ਅੱਛਾ ਜੀ ਅਤੇ ਆਪਣਾ ਇਸ ਟੈਮ ਦੁਕਾਨ 'ਤੇ ਕੌਣ ਹੋਵੇਗਾ ਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਜੇ ਤੁਹਾਡਾ ਇੱਕ ਬੰਦਾ ਫ੍ਰੀ ਇਸ ਟੈਮ ਕੋਈ ਹੋਰ ਹੋਵੇ ਆ ਕੇ ਜਿਵੇਂ ਹਨ ਲੱਗਦਾ ਤੁਸੀਂ ਵੇਖ ਕੇ ਆਪੇ ਲਿਸਟ ਬਣਾ ਦਿੰਦੇ

ਹਾਂਜੀ ਹਾਂਜੀ ਕਿਓਂ ਸਾਨੂੰ ਤਾਂ ਪਤਾ ਨਹੀਂ ਚੱਲਣਾ ਕੀ ਚੀਜ਼ ਹੈ ਕੀ ਹੈ ਨਹੀਂ ਅਤੇ ਜਿਹੜਾ ਮਿਸਤਰੀ ਬੰਦਾ ਉਹ ਹੀ ਦੱਸੂਗਾ ਸਮਾਨ ਇਹ ਹੈਗਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਥੈਂਕਿਊ